ਹਾਂਜੀ ਕੌਣ ਹਾਂਜੀ ਦੱਸੋ ਹਾਂਜੀ ਹਾਂਜੀ ਦੱਸੋ ਅੱਛਾ ਜੀ ਪੀਜੀ ਤਾਂ ਵੀਰ ਜੀ ਇੱਥੇ ਸ਼ਹਿਰ 'ਚ ਸਾਡੇ ਫਿਰੋਜ਼ਪੁਰ ਸ਼ਹਿਰ 'ਚ ਬਹੁਤ ਘੱਟ ਨੇ ਜੇ ਤੁਸੀਂ ਕਹੋ ਪੀਜੀ ਤਾਂ ਉਹ ਜਿਹੜੇ ਕਾਲਜ 'ਚ ਤੁਸੀਂ ਕਹਿ ਰਹੇ ਹੋ ਅਤੇ ਆਰਐਸਡੀ 'ਚ ਹੀ ਹੋ ਨਾ ਅਤੇ ਜੇ ਤੁਸੀਂ ਉੱਥੇ ਕਹਿ ਰਹੇ ਹੋ ਤਾਂ ਉਥੋਂ ਪੀਜੀ ਬਹੁਤ ਦੂਰ ਆ ਜਿੰਨੇ ਵੀ ਮੁੰਡੇ ਹੈਗੇ ਆ ਮੈਂ ਉਹਨਾਂ ਨੂੰ ਜਿਹਨਾਂ ਨੂੰ ਜਾਣਦਾ ਉੱਥੇ ਦੀ ਕਾਲਜ ਵਾਲਿਆਂ ਨੂੰ ਉਹ ਜ਼ਿਆਦਾਤਰ ਰੈਂਟ 'ਤੇ ਰਹਿ ਕੇ ਕਮਰੇ ਲੈ ਲੈਂਦੇ ਆ ਕਿਸੇ ਦਾ ਵੀ ਇੱਕ ਛੋਟਾ ਜਿਹਾ ਅਤੇ ਉਹਦੇ ਵਿੱਚ ਤਿੰਨ ਚਾਰ ਜਾਣੇ ਐਡਜਸਟ ਹੋ ਜਾਂਦੇ ਆ ਕਿਉਂਕਿ ਤੁਹਾਨੂੰ ਪਤਾ ਕਿ ਫਿਰੋਜ਼ਪੁਰ ਏਡਾ ਕੋਈ ਵੱਡਾ ਸ਼ਹਿਰ ਤਾਂ ਹੈ ਨਹੀਂ ਕਿਉਂਕਿ ਜਿੱਥੇ ਇੱਥੇ ਅਮੀਰ ਘਰਾਂ ਦੇ ਬੱਚੇ ਆਉਣਗੇ ਹੈ ਨਾ ਮਹਿੰਗੇ ਮਹਿੰਗੇ ਪੀਜੀਆਂ ਦੀ ਫੀਸਾਂ ਭਰਨਗੇ ਹਾਂਜੀ ਇਸ ਕਰਕੇ ਤਾਂ ਪੀਜੀ ਤੁਸੀਂ ਕਹਿ ਦਿਓ ਕਿ ਨਾ ਦੇ ਬਰਾਬਰ ਹੈ ਕਿ ਨਾ ਕਹਿ ਲਓ ਜਾਂ ਇੱਕ ਅੱਧਾ ਕਹਿ ਲਓ ਇੱਕੋ ਬਰਾਬਰ ਹੈ

ਅੱਛਾ ਜੀ ਆਪਣਾ ਉਹਨਾਂ ਕੋਈ ਨਹੀਂ ਵੀਰ ਜੀ ਨਾ ਮੈਂ ਨਾ ਇੱਦਾਂ ਕਰਦਾ ਅਤੇ ਮੈਂ ਦੇਖਦਾ ਹਾਂ ਤੁਹਾਡੇ ਵਾਸਤੇ ਬਾਕੀ ਕਿਉਂਕਿ ਮੈਂ ਤੁਹਾਨੂੰ ਤੁਹਾਨੂੰ ਦੱਸਿਆ ਹੀ ਹੋਣਾ ਜਿਹਨੇ ਤੁਹਾਨੂੰ ਨੰਬਰ ਦਿੱਤਾ ਕਿ ਮੈਂ ਲੋਕਲ ਹੈਗਾ ਇੱਥੋਂ ਦਾ ਇਸ ਕਰਕੇ ਮੈਂ ਕੋਈ ਨਹੀਂ ਦੇਖਦਾ ਹਾਂ ਤੁਹਾਡੇ ਵਾਸਤੇ ਜੇ ਮੈਨੂੰ ਕੋਈ ਮਿਲਦਾ ਅਤੇ ਮੈਂ ਤੁਹਾਡਾ ਨੰਬਰ ਸੇਵ ਕਰ ਲੈਂਦਾ ਹੈ ਨਾ ਠੀਕ ਹੈ ਅਤੇ ਕੋਈ ਗੱਲ ਨਹੀਂ ਬਾਕੀ ਜੇ ਰੋਟੀ ਪਾਣੀ ਦਾ ਕੁਝ ਹੋਏਗਾ ਤਾਂ ਕੋਈ ਗੱਲ ਨਹੀਂ ਇੱਕ ਦੋ ਦਿਨ ਤਾਂ ਤੁਸੀਂ ਮੇਰੇ ਘਰ ਵੀ ਐਡਜਸਟ ਹੋ ਸਕਦੇ ਹੋ ਪਰ ਤੁਹਾਨੂੰ ਪਤਾ ਕਿ ਜ਼ਿਆਦਾ ਦੇਰ ਤਾਂ ਹੈ ਨਾ ਕੋਈ ਵੀ ਨਹੀਂ ਜਰ ਪਾਉਂਦਾ ਹਾਂ ਅਤੇ ਅਤੇ ਉਹ ਤਾਂ ਉਹ ਤਾਂ ਜੀ ਹਮ ਜੀ ਜੀ ਜੀ ਉੱਤੋਂ ਦੇਖੋ ਜੀ ਸਿਰ 'ਤੇ ਪੇਪਰ ਆ ਗਏ ਹੈ ਤੁਹਾਡੇ ਨਵੇਂ ਬੱਚਿਆਂ ਦੇ ਸਿਰ 'ਤੇ ਪੇਪਰ ਵੀ ਆ ਗਏ ਰੋਟੀ ਤਾਂ ਦੇਖੋ ਵੀ ਮੈਂ ਤੁਹਾਨੂੰ ਇੱਕ ਸਲਾਹ ਦੇ ਸਕਦਾ ਕਿ ਕਿਤੇ ਵੀ ਜਿਵੇਂ ਕਿ ਆਪਾਂ ਨੂੰ ਹੋਟਲ ਜਾਂ ਢਾਬਾ ਮਿਲਦਾ ਨਾ ਨੇੜੇ ਹੈਗਾ ਕਾਲਜ ਦੇ ਵਾਹਵਾ ਹੀ ਅਤੇ ਉੱਥੇ ਤੁਸੀਂ ਕਿਰਾਏ 'ਤੇ ਜਿਵੇਂ ਰੋਟੀ ਲਵਾ ਲਓ ਉਧਾਰ 'ਤੇ ਇੱਕ ਮਹੀਨੇ ਬਾਅਦ ਪੈਸੇ ਦੇ ਕੇ ਉਹ ਮੇਰੇ ਖਿਆਲ ਨਾਲ ਮੈਂ ਤੁਹਾਡੀ ਗੱਲ ਕਰਵਾ ਦਾਂਗਾ ਉਹ ਚਾਰ ਜਾਂ ਪੰਜ ਸੌ ਦੇ ਵਿੱਚ ਮਹੀਨੇ ਦੀ ਰੋਟੀ ਤੁਹਾਨੂੰ ਪੂਰੀ ਦੇਣਗੇ ਤਿੰਨੋਂ ਟਾਈਮ ਦੀ ਜੇ ਤੁਸੀਂ ਦੋ ਟਾਈਮ ਦੀ ਲਾਣੀ ਤੋਂ ਹੋਰ ਥੋੜ੍ਹੀ ਹੋ ਜੇਗੀ ਅਤੇ ਜੇ ਕੱਪੜੇ ਧੋਣ ਦੀ ਗੱਲ ਹੈ ਤਾਂ ਉਹ ਕੋਈ ਗੱਲ ਨਹੀਂ ਆਪਣੇ ਘਰ ਮਸ਼ੀਨ ਹੈਗੀ ਹੈ ਜਦੋਂ ਤੁਸੀਂ ਪਾਉਣੇ ਹੋਣ ਤੁਸੀਂ ਉਦੋਂ ਕਹਿ ਦਿਆ ਕਰਿਓ ਆਪਾਂ ਕੋਈ ਗੱਲ ਨਹੀਂ ਕਰ ਲਵਾਂਗੇ ਬਾਕੀ ਹੋਰ ਦੱਸੋ ਜੇ ਹੋਰ ਕੁਝ ਕਰ ਸਕਦੇ ਹਾਂ ਜੀ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਦੇਖੋ ਜੀ ਪੜ੍ਹ ਕੇ ਬਹੁਤ ਦੂਰ ਦੂਰ ਜਾਣਾ ਬਹੁਤ ਔਖਾ ਸਿੱਧੀ ਗੱਲ ਹੈ ਅਤੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਇੱਕ ਦੋ ਦਿਨਾਂ ਵਿੱਚ ਮੈਂ ਤੁਹਾਡੇ ਵਾਸਤੇ ਲੱਭ ਲੈਂਦਾ ਟਿਕਾਣਾ ਲੱਭ ਲੈਂਦਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹੀ ਸਲਾਹ ਦੇਵਾਂਗਾ ਵੀ ਮੈਂ ਤੁਹਾਨੂੰ ਇਹੋ ਜਿਹਾ ਕਮਰਾ ਲੱਭ ਕੇ ਦਿੰਦਾ ਜਿਹ 'ਚ ਅੱਗੇ ਤਿੰਨ ਚਾਰ ਜਾਣੇ ਰਹਿੰਦੇ ਆ ਤਿੰਨ ਚਾਰ ਜਣੇ ਰਹਿੰਦੇ ਹੋਣ ਕਿ ਤੁਹਾਨੂੰ ਕਿਰਾਇਆ ਵੀ ਘੱਟ ਆਵੇ ਵੀ ਜੇ ਉਹਦਾ ਕਿਰਾਇਆ ਅੱਠ ਨੌਂ ਸੌ ਰੁਪਏ ਤਾਂ ਤੁਹਾਨੂੰ ਡੇਢ ਦੋ ਸੌ ਰੁਪਿਆ ਕਿਰਾਇਆ ਆਵੇ ਉਹ ਕਮਰੇ ਦਾ ਸਾਰਾ ਵੀ ਤੁਹਾਡੇ 'ਤੇ ਵੀ ਨਾ ਬੋਝ ਪਵੇ ਵੀ ਦੇਖੋ ਸਾਰੇ ਮਜਬੂਰੀਆਂ ਦੇ ਮਾਰੇ ਆਉਂਦੇ ਦੂਰ ਪੜ੍ਹਨ ਵਾਸਤੇ ਕੋਈ ਹੈ ਨਾ ਆਪਾਂ ਇੰਨੇ ਵੱਡੇ ਘਰਾਂ ਦੇ ਨਹੀਂ ਹੈਗੇ ਕਿ ਆਪਾਂ ਹੈ ਨਾ ਪੀਜੀਆਂ 'ਚ ਵ ਵੱਧ ਕਰਾਇਆ ਇਕੱਲੇ ਦਾ ਸੀਗੀਆਂ ਹੈ ਨਾ ਉਹਦੇ 'ਚ ਛੋਟੀ ਜਿਹੀ ਕਿਚਨ ਹੋਏਗੀ ਉਹ 'ਚ ਤੁਹਾਡਾ ਰੋਟੀ ਦਾ ਵੀ ਸਾਰਾ ਕੰਮ ਹੋ ਜਾਏਗਾ ਠੀਕ ਹੈ ਅਤੇ ਕੋਈ ਗੱਲ ਨਹੀਂ ਤੁਸੀਂ ਟੈਂਸ਼ਨ ਨਾ ਲਓ ਮੈਂ ਤੁਹਾਡਾ ਦੇਖ ਲਵਾਂਗਾ ਕੋਈ ਨਹੀਂ ਤੁਸੀਂ ਨੰਬਰ ਲਿੱਤਾ ਮੇਰਾ ਨੰਬਰ ਸੇਵ ਕਰ ਲਿਓ ਮੈਨੂੰ ਕੋਈ ਨਹੀਂ ਕੱਲ੍ਹ ਫੋਨ ਲਾ ਲਿਓ ਇੱਕ ਵਾਰੀ ਜੀ ਜੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਮ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਬਾਈ ਜੀ ਮੈਂ ਦੇਖਦਾ ਠੀਕ ਹੈ ਜੀ ਓਕੇ ਓਕੇ ਜੀ ਓਕੇ ਓਕੇ ਓਕੇ